ਮੈਂ ਕੁਝ ਕੁ ਸਮਾਂ ਪਹਿਲਾਂ ਕੱਪੜੇ ਦਾ ਕੰਮ ਕਰਨ ਬਾਰੇ ਸੋਚਿਆ ਸੀ ਅਤੇ ਮੈਨੂੰ ਲੱਗਦਾ ਮੈਂ ਆਪਣੀ ਜ਼ਿੰਦਗੀ 'ਚ ਹੁਣ ਤੱਕ ਦਾ ਸਭ ਤੋਂ ਮਹੱਤਵਪੂਰਨ ਫੈਸਲਾ ਆਪਣੇ ਕੈਰੀਅਰ ਲਈ ਹੀ ਲਿਆ ਅਤੇ ਉਦੋਂ ਵੀ ਮੈਂ ਬਹੁਤ ਕਨਫਿਊਜ਼ ਸੀ ਸੋਚ ਰਿਹਾ ਸੀ ਵੀ ਕਰਾਂ ਕਿ ਨਾ ਕਰਾਂ ਅਤੇ ਮੇਰੇ ਦਿਮਾਗ ਵਿੱਚ ਇਹੀ ਖਿਆਲ ਵਾਰ ਵਾਰ ਆ ਰਿਹਾ ਸੀ ਕਿ ਜੇ ਕੁਝ ਕਰਨਾ ਹੈ ਤਾਂ ਰਿਸਕ ਤਾਂ ਲੈਣਾ ਹੀ ਪੈਣਾ ਹੈ ਨਾ ਰਿਸਕ ਲਏ ਬਿਨਾਂ ਕੁਝ ਨਹੀਂ ਹੁੰਦਾ ਹੈਗਾ ਜੇ ਰਿਸਕ ਲਵਾਂਗੇ ਤਾਂ ਹੀ ਕੁਝ ਬਣੇਗਾ ਪਰ ਮੇਰਾ ਮਨ ਫਿਰ ਵੀ ਡਰਦਾ ਸੀ ਵੀ ਕੰਮ ਚੱਲੂ ਕਿ ਨਹੀਂ ਚੱਲੂ ਕਿਉਂਕਿ ਕਿਉਂਕਿ ਹੁਣ ਇਹ ਕੰਮ ਜਿਹੜਾ ਕੱਪੜੇ ਦਾ ਕੰਮ ਹੈ ਇਹਦੇ ਵਿੱਚ ਮੁਕਾਬਲਾ ਬਹੁਤ ਸੀ ਸਾਰੇ ਪਾਸੇ ਬਹੁਤ ਸਾਰੀਆਂ ਦੁਕਾਨਾਂ ਸ਼ੋਅਰੂਮ ਹਰੇਕ ਸ਼ਹਿਰ 'ਚ ਸ਼ੋਅਰੂਮ ਦੁਕਾਨਾਂ ਬਹੁਤ ਸਾਰੀਆਂ ਖੁੱਲ੍ਹੀਆਂ ਹੋਈਆਂ ਨੇ ਹਰ ਪਾਸੇ ਕੱਪੜੇ ਦਾ ਹੀ ਕੰਮ ਆ ਉੱਥੇ ਦੁਕਾਨ ਇੱਥੇ ਦੁਕਾਨ ਹੈ ਨਾ ਅਤੇ ਮੈਂ ਫਿਰ ਕੋਈ ਫੈਸਲਾ ਨਹੀਂ ਲੈ ਪਾ ਰਿਹਾ ਸੀ ਫਿਰ ਫਿਰ ਜਦੋਂ ਮੈਂ ਇੰਨਾਂ ਕਨਫਿਊਜ਼ ਸੀ ਮੈਨੂੰ ਸਮਝ ਨਹੀਂ ਆ ਰਿਹਾ ਸੀ ਕੁਛ ਤਾਂ ਮੈਂ ਆਪਣੇ ਵੱਡੇ ਭਰਾ ਦੀ ਹੈਲਪ ਲਈ ਅਤੇ ਜਦੋਂ ਇਹੋ ਜਿਹਾ ਕੰਮ ਅੜਦਾ ਤਾਂ ਮੈਂ ਆਪਣੇ ਵੱਡੇ ਭਰਾ ਦੀ ਸਲਾਹ ਲੈਂਦਾ ਹੁੰਦਾ ਅਤੇ ਉਦੋਂ ਵੀ ਮੈਂ ਆਪਣੇ ਵੱਡੇ ਭਰਾ ਦੀ ਸਲਾਹ ਲਈ ਅਤੇ ਫਿਰ ਮੈਨੂੰ ਮੇਰੇ ਬ ਬਰਦਰ ਵੱਡੇ ਭਰਾ ਨੇ ਮੈਨੂੰ ਬਹੁਤ ਵਧੀਆ ਸਲਾਹ ਦਿੱਤੀ ਅਤੇ ਸਮਝਾਇਆ ਉਹਨੇ ਕਿਹਾ ਵੀ ਚਲ ਤੂੰ ਕਰ ਕੰਮ ਵੀ ਕੋਈ ਮੈਂ ਤੇਰੇ ਨਾਲ ਹੀ ਖੜ੍ਹਾਂ ਜਿੱਦਾਂ ਵੀ ਹੋਵੇਗਾ ਅਤੇ ਮੈਨੂੰ ਵਧੀਆ ਸਲਾਹ ਦੇ ਕੇ ਗਾਈਡ ਕੀਤਾ ਉਹਨਾਂ ਨੇ ਅਤੇ ਉਦੋਂ ਦਾ ਫਿਰ ਮੇਰਾ ਸਭ ਦੇ ਇਹ ਵਾਲਾ ਫੈਸਲਾ ਜਿਹੜਾ ਉਹਨਾਂ ਨੇ ਦਿੱਤਾ ਸੀ ਮੈਨੂੰ ਸਲਾਹ ਦਿੱਤੀ ਮੇਰਾ ਵਧੀਆ ਚੱਲ ਰਿਹਾ ਉਦੋਂ ਦਾ ਕੰਮ